ਹਾਂਜੀ ਹਾਂਜੀ ਟੇਲਰ ਮੈਡਮ ਬੋਲਦੇ ਹੈ ਹੋਰ ਕਿਆ ਹਾਲ ਚਾਲ ਹੈ ਭੈਣ ਜੀ

ਬਸ ਆਉਣਾ ਤਾ ਰਾਜੇ ਟਾਈਮ ਨਹੀਂ ਮਿਲਿਆ ਹੈਗਾ ਹੁਣ ਆਊਗੀ ਮੈਂ ਤੁਸੀਂ ਘਰੇ ਹੋ ਅੱਜ ਸੂਟ ਸਿਲਾਣੇ ਦੇਣੇ ਸੀ ਮੈਂ ਹਾਂ ਹੋਰ ਕਿਵੇਂ ਦਾ ਹੁਣ ਕੱਪੜਾ ਕੁਪੜਾ ਕਿਵੇਂ ਦਾ ਚੱਲਦਾ ਅੱਜ ਕੱਲ੍ਹ ਫੇਰ ਟਾਈਮ ਨਹੀਂ ਮਿਲਿਆ ਅਜੇ ਲਾਈਨਿੰਗ ਲਈ ਲਾਈਨਿੰਗ ਵਾਲੇ ਸੂਟ ਹੈ ਨਾ ਫੇਰ ਅੱਛਾ ਜੀ ਮੈਂ ਲੈਸ ਲੂਸ ਵੀ ਲਵਾਉਣੀ ਹੈ ਅਤੇ ਕਿੰਨਾ ਕੁ ਟਾਈਮ ਲੱਗ ਜੂਗਾ ਅੱਛਾ ਜੀ ਅਤੇ ਉਹ ਸਲਵਾਰ ਨੂੰ ਕਿੰਨਾ ਕੱਪੜਾ ਲੱਗਦਾ ਜਿਹੜੀ ਫੁੱਲ ਪਟਿਆਲਾ ਬਣਾਉਣੀ ਹੈ ਅੱਛਾ ਅੱਛਾ ਠੀਕ ਅਤੇ ਹਾਂ ਉਹ ਅਤੇ ਉਹ ਵੀ ਲਵਾਉਣੇ ਹੈ ਉਹਨੂੰ ਅੱਗੇ ਬ ਬਟਨ ਨਹੀਂ ਨਹੀਂ ਉਹ ਨਹੀਂ ਲਾਉਂਦੇ ਹੈਗੇ ਕੋਲੀ ਕੋਲੀ ਬਟਨ ਕੋਟਲੀ ਬਟਨ ਹਾਂ ਹਾਂ ਲਟਕਣ ਲੁਟਕਣ ਵੀ ਲਗਾ ਦਿਉ ਕਦ ਕੁ ਆਈਏ ਅਸੀਂ ਕਿੰਨੇ ਕੁ ਅੱਛਾ ਅੱਛਾ ਚੱਲ ਮੈਂ ਫਿਰ ਨਿਬੇੜ ਕੇ ਕੰਮ ਕੁੰਮ ਫਿਰ ਆਉਂਦੀ ਹਾਂ ਮੈਂ ਥੋੜ੍ਹਾ ਜਿਹਾ ਕੰਮ ਹੈ ਇੱਕ ਦੋ ਹਾਂ ਜਲਦੀ ਬਣਾ ਦਿਉ ਮੈਨੂੰ ਜਲਦੀ ਚਾਹੀਦੇ ਆ ਹਾਂ ਹਾਂ ਠੀਕ ਹੈ ਚੰਗਾ ਹਾਂ ਚੰਗਾ ਠੀਕ ਹੈ ਭੈਣੇ ਓਕੇ